ਸਾਡੇ ਪਕਵਾਨ ਪੰਜਾਬ ਦਾ ਕੋਈ ਜਵਾਬ ਨਹੀਂ ਸਾਗ ਮੱਕੀ ਦੀ ਰੋਟੀ ਮੱਖਣ ਲੱਸੀ ਪੂਰੀ ਦੁਨੀਆ ਦੇ ਵਿੱਚ ਇਹ ਮਸ਼ਹੂਰ ਹੈ ਜਿਹਨੇ ਇਹ ਖਾ ਲਿਆ ਉਹਦੀ ਸਿਹਤ ਦੂਜਿਆਂ ਨਾਲੋਂ ਲਾਜਵਾਬ ਜਿਹਨੂੰ ਅਸੀਂ ਕਹਿੰਦੇ ਹਾਂ ਜਿਸ ਦਾ ਕੋਈ ਮੋਲ ਨਹੀਂ